ਸਤਿ ਸ੍ਰੀ ਅਕਾਲ ਮੈਂ ਉਬਰ ਦੀ ਕਸਟਮਰ ਸਰਵਿਸ ਨਾਲ ਗੱਲ ਕਰ ਸਕਦੀ ਹਾਂ ਸਰਵਿਸ ਰੀਪਰੀਜੇਟੇਟਿਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ ਜੀ ਮੈਂ ਕੁਝ ਸਮੇਂ ਪਹਿਲਾਂ ਇੱਕ ਰੀਡਬੁੱਕ ਔਰਡਰ ਕੀਤੀ ਸੀ ਪਰ ਮੈਨੂੰ ਕਿਸੇ ਮਜ਼ਬੂਰੀ ਕਰਕੇ ਕੈਂਸਲ ਕਰਨੀ ਪਈ ਮੈਨੂੰ ਰਿਫੰਡ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਮੈਂ ਪੰਦਰਾਂ ਸੌ ਰੁਪਏ ਪੂਰੀ ਪੇਮੈਂਟ ਕੀਤੀ ਹੈ ਸਰਵਿਸ ਰੀਪਰੀਜੇਟੇਟਿਵ ਠੀਕ ਹੈ ਕਿਰਪਾ ਕਰਕੇ ਮੈਂ ਤੁਹਾਨੂੰ ਹੋਰ ਜਾਣਕਾਰੀ ਦੇਣ ਲਈ ਤੈਅ ਕਰ ਰਿਹਾ ਹਾਂ ਕਿ ਮੈਂ ਕਾਰਨ ਦੱਸਣਾ ਚਾਹੁੰਦੀ ਹਾਂ ਕਿ ਅਚਾਨਕ ਕੁਝ ਪੈਸਿਆਂ ਦੀ ਮੈਨੂੰ ਜ਼ਰੂਰਤ ਪੈ ਗਈ ਮੈਂ ਰੀਡਬੁੱਕ ਨਹੀਂ ਲੈ ਸਕੀ ਸਰਵਿਸ ਰੀਪਰੀਜੇਟੇਟਿਵ ਠੀਕ ਹੈ ਤੁਸੀਂ ਸਹੀ ਹੋ ਤੁਹਾਨੂੰ ਰਿਫੰਡ ਵਾਪਸ ਕੀਤਾ ਜਾਵੇਗਾ ਤੁਹਾਡੇ ਖਾਤੇ ਵਿੱਚ ਪੈਸੇ ਵਾਪਸ ਕਰ ਦਿੱਤੇ ਜਾਣਗੇ ਧੰਨਵਾਦ ਬਹੁਤ ਸਾਰਾ ਸਾਰਾ